ਹਾਂਜੀ ਸਾਡੇ ਨੇੜੇ ਕਲਾ ਕਲਾ ਸਪਲਾਈ ਸਟੋਰ ਹੈ ਜਿਹੜੀਆਂ ਕਿ ਸਟੇਸ਼ਨਰੀ ਦੀਆਂ ਚੀਜ਼ਾਂ ਅਸੀਂ ਖਰੀਦਦੇ ਹਨ ਉਸੀ ਸਟੋਰ ਤੋਂ ਅਸੀਂ ਨਵਾਂ ਸ਼ਹਿਰ ਦੇੇ ਕੋਲ ਕੋਲੋਂ ਖਰੀਦਦੇ ਹਨ ਪੂਮਾ ਦੇ ਸਟੋਰ ਦੇ ਨਾਲ ਇਹ ਸਟੇਸ਼ਨਰੀ ਸਟੋਰ ਨਵਾਂ ਸ਼ਹਿਰ ਦੇ ਵਿੱਚੋਂ ਅਸੀਂ ਵਧੀਆ ਸਮਾਨ ਇੱਥੋਂ ਖਰੀਦਦੇ ਹਾਂ ਅਤੇ ਜਿਵੇਂ ਕਿ ਡਰਾਇੰਗ ਮੈਨੂੰ ਪਸੰਦ ਹੈ ਅਤੇ ਮੈਂ ਡਰਾਇੰਗ ਦਾ ਸਮਾਨ ਜਿਵੇਂ ਕਿ ਨੇਚਰਸ ਵਾਈਸ ਕੁਦਰਤ ਦੇ ਕੁਦਰਤ ਦੇ ਸਰੋਤਾਂ ਦੀਆਂ ਜਿਹੜੀਆਂ ਪਿਕਚਰਾਂ ਡਰਾਇੰਗ ਕਰਨੀ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਅਤੇ ਮੈਂ ਉੱਥੋਂ ਹੀ ਅਕਸਰ ਸਟੇਸ਼ਨਰੀ ਦੁਕਾਨ ਤੋਂ ਜਾ ਕੇ ਖਰੀਦਦਾ ਹਾਂ ਉਸ ਦੇ ਸਾਰੇ ਬਰੱਸ਼ਿਸ ਰੰਗ ਪੈਨਸਲਾਂ ਸਭ ਕੁਛ ਮੈਂ ਉੱਥੋਂ ਹੀ ਖਰੀਦਦਾ ਇਹ ਸਾਰੀ ਸਮੱਗਰੀ ਉੱਥੋਂ ਖਰੀਦਦਾ ਹਾਂ